ਤਾਰੇ ਇੱਕ ਸਵੈ ਪ੍ਰਕਾਸ਼ਿਤ ਹਨ ਇਹ ਇੱਕ ਖਗੋਲਿਕ ਪਿੰਡ ਸਨ ਇਹ ਸਾਨੂੰ ਬਿੰਦੂ ਦੀ ਤਰ੍ਹਾਂ ਦਿਖਾਈ ਦਿੰਦੇ ਹਨ ਅਤੇ ਰਾਤ ਨੂੰ ਹਨੇਰੇ ਵਿੱਚ ਟਿਮਟਿਮਾਉਂਦੇ ਹਨ ਅਤੇ ਇਸ ਦੇ ਬਾਰੇ ਬਹੁਤ ਸਾਰੇ ਮਿਥਿਹਾਸ ਹਨ ਸਭ ਤੋਂ ਪ੍ਰਸਿੱਧ ਮਿਥਿਹਾਸ ਇਹ ਹੈ ਕਿ ਅਸੀਂ ਮੰਨਦੇ ਹਾਂ ਕਿ ਜਿਹੜੇ ਲੋਕ ਮਰ ਜਾਂਦੇ ਹਨ ਉਹ ਉਪਰ ਜਾ ਕੇ ਤਾਰੇ ਬਣ ਜਾਂਦੇ ਹਨ ਜਦਕਿ ਇੱਦਾਂ ਦਾ ਕੁਛ ਵੀ ਨਹੀਂ ਹੈ